ਪੰਜਾਬ ਵਿੱਚ ਸਿਹਤ ਸੰਭਾਲ ਕਰਮਚਾਰੀ ਕਿਵੇਂ ਸਿਖਲਾਈ ਪ੍ਰਾਪਤ ਅਤੇ ਸਮਰਥਿਤ ਹਨ ਅਤੇ ਰਾਜ ਵਿੱਚ ਸਿਹਤ ਸੰਭਾਲ ਪੇਸ਼ਾਵਰਾਂ ਦੇ ਸਾਹਮਣੇ ਮੁੱਖ ਚੁਣੌਤੀਆਂ ਹਨ ਸ ਫਸਟ ਆਫ ਆਲ ਸਿੱਖਿਆ ਅੱਜ ਕੱਲ੍ਹ ਸਿੱਖਿਆ ਸਿੱਖਿਆ ਬਹੁਤ ਮਹਿੰਗੀ ਹੈ ਕੋਸਟਲੀ ਹੋਈ ਹੋਈ ਹੈ ਜਿਸ ਕਰਕੇ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈਗਾ ਵੀ ਚੰਗੀ ਸ਼ਿਕਸ਼ਾ ਪ੍ਰਾਪਤ ਕਰਨ ਅਤੇ ਸਿਖਲਾਈ ਸਿਖਲਾਈ ਦੇ ਵਿੱਚ ਮੁੱਖ ਚੁਣੌਤੀਆਂ ਇਹ ਹੈ ਕਿ ਪੂਰੀ ਪ੍ਰੋਪਰ ਐਕਟੀਵਿਟੀ ਐਕਟਿਵ ਲਰਨਿੰਗ ਨਹੀਂ ਹੈਗੀ ਜਿਸ ਵਿੱਚ ਬੱਚੇ ਆਪਣੇ ਆਪ ਨੂੰ ਪੂਰਾ ਐਕਟਿਵ ਕਰਕੇ ਪੂਰੇ ਧਿਆਨ ਨਾਲ ਪੜ੍ਹਾਈ ਪੜ੍ਹਾਈ ਜਾਂ ਸਿਖਲਾਈ ਪ੍ਰਾਪਤ ਕਰ ਸਕਣ ਧਾਰਨ ਧਾਰਨ ਅੱਜ ਕੱਲ੍ਹ ਸਿਹਤ ਸੰਭਾਲ ਕਰਮਚਾਰੀ ਬਹੁਤ ਜ਼ਿਆਦਾ ਢੰਗ ਨਾਲ ਕੰਮ ਵੀ ਨਹੀਂ ਕਰਦੇ ਬਹੁਤ ਜ਼ਿਆਦਾ ਕਈ ਕਈ ਕਈ ਤਾਂ ਇਸ ਤਰ੍ਹਾਂ ਕੰਮ ਕਰਦੇ ਹਨ ਕਿ ਜਿੱਦਾਂ ਤਾਂ ਉਹਨਾਂ ਦਾ ਆਪਣਾ ਕਿੱਤਾ ਨਹੀਂ ਹੁੰਦਾ ਉਹ ਕਿਸੇ ਮਜ਼ਬੂਰੀ 'ਚ ਕੰਮ ਕਰਦੇ ਆ ਇਸ ਕਰਕੇ ਪੰਜਾਬ ਵਿੱਚ ਸਿਹਤ ਸੰਭਾਲ ਕਰਮਚਾਰੀ ਸਿਖਲਾਈ ਪ੍ਰਾਪਤ ਕਰਨ ਵਿੱਚ ਚੰਗੀ ਤਰ੍ਹਾਂ ਸਮਰਥ ਸਮਰਥਿਤ ਨਹੀਂ ਹਨ ਵਰਨਾ ਉਹ ਇਹ ਹੈ ਕਿ ਮਤਲਬ ਅੱਜ ਕੱਲ੍ਹ ਕਾਲਜਸ ਦੇ ਵਿੱਚ ਚੰਗੀ ਤਰ੍ਹਾਂ ਸਿਖਲਾਈ ਜੋ ਸਿਖਲਾਈ ਲਈ ਬਹੁਤ ਕਈ ਕਾਲਜਾਂ ਦੇ ਵਿੱਚ ਕਾਲਜਾਂ ਦੇ ਵਿੱਚ ਮੈਡੀਕਲ ਕਾਲਜਾਂ ਦੇ ਵਿੱਚ ਲੈਬਸ ਨਹੀਂ ਹੁੰਦੀਆਂ ਹੋਰ ਬਹੁਤ ਕੁਛ ਆ ਹੋਸਪੀਟਲਸ ਦੇ ਵਿੱਚ ਬੱਚਿਆਂ ਬੱਚਿਆਂ ਤੋਂ ਕੰਮ ਕਰਵਾਉਣਾ ਬਹੁਤ ਜ਼ਿਆਦਾ ਗੈਰ ਕਾਨੂੰਨੀ ਆ